ਹੈਂਡ ਐਂਡ ਸ਼ੋਲਡਰ ਦਾ ਨੈਗੇਟਿਵ ਐਕਸਪੀਰੀਐਂਸ ਇਹ ਹੈ ਕਿ ਸਿਰ ਨਹਾਉਣ ਸਮੇਂ ਇਹ ਕੁਆਂਟਟੀ ਮਤਲਬ ਜ਼ਿਆਦਾ ਮਾਤਰਾ ਵਿੱਚ ਲਗਾਉਣਾ ਪੈਂਦਾ ਹੈ ਅਤੇ ਵਾਲ ਜਲਦੀ ਸ ਸ ਸਾਫ ਨਹੀਂ ਹੁੰਦੇ